ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਬੁਲਾਡੇ ਵਿੱਚ ਰਹਿੰਦੀ ਹਾਂ ਪਰ ਮੈਨੂੰ ਨਹੀਂ ਲੱਗਦਾ ਕਿ ਇੱਥੇ ਸਰੋਤਾਂ ਦੀ ਘਾਟ ਹੈ ਕਿਉਂਕਿ ਮੈਨੂੰ ਕਦੇ ਵੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਅਤੇ ਬੁਲਾਡੇ ਨਹੀਂ ਮਿਲ ਸਕਦੀ ਬੁਲਾਡੇ ਦੇ ਲੋਕ ਬੁਲਾਡੇ ਦੇ ਵਿੱਚ ਹਰ ਚੀਜ਼ ਮਿਲ ਜਾਂਦੀ ਹੈ ਮੈਨੂੰ ਤੀ ਜਿੱਥੋਂ ਤੱਕ ਜਿੱਥੋਂ ਤੱਕ ਗੱਲ ਆਉਂਦੀ ਲੋਕਾਂ ਦੇ ਵਿੱਚ ਟੀਕੇ ਅਤੇ ਟੀਕਾਕਰਨ ਕੇਂਦਰ ਦੀ ਹਾਂ ਸਾਨੂੰ ਮੁੱਢਲੇ ਟਾਈਮ ਦੇ ਵਿੱਚ ਬਚਪਨ ਦੇ ਵਿੱਚ ਸਾਨੂੰ ਟੀਕਾਕਰਨ ਮਤਲਬ ਸਾਡਾ ਟੀਕਾਕਰਨ ਪੂਰੇ ਟਾਈਮ 'ਤੇ ਹੋਇਆ ਇੱਥੋਂ ਤੱਕ ਕਿ ਜਿਹੜੇ ਡੋਕਟਰ ਨੇ ਉਹ ਘਰ ਘਰ ਆ ਕੇ ਸਾਡੀਆਂ ਮਾਵਾਂ ਨੂੰ ਮਤਲਬ ਐਜੂਕੇਟ ਕਰਦੇ ਸੀਗੇ ਕਿ ਤੁਸੀਂ ਟੀਕੇ ਲਗਵਾਓ ਆਪਣੇ ਬੱਚਿਆਂ ਦੇ ਜਿਹੜੇ ਤਿੰਨ ਟੀਕੇ ਜ਼ਰੂਰੀ ਹੁੰਦੇ ਨੇ ਕੁਝ ਉਮਰ ਦੇ ਲਈ ਮੈਨੂੰ ਐਗਜੈਕਟਲੀ ਉਮਰ ਯਾਦ ਨਹੀਂ ਹੈ ਬਟ ਹਾਂ ਸਾਨੂੰ ਮੈਨੂੰ ਯਾਦ ਹੈ ਕਿ ਉਹ ਮੇਰੇ ਘਰ ਆ ਉਹ ਮੇਰੇ ਟੀਕੇ ਲੱਗੇ ਸੀਗੇ ਹਾਂ ਜੇ ਗੱਲ ਕਰੀਏ ਆਪਾਂ ਹੋਰ ਪਸ਼ੂ ਕੱਟਣ 'ਤੇ ਜਿਵੇਂ ਕੁੱਤੇ ਕੱਟ ਜਾਂਦੇ ਜਾਂ ਇਹਨਾਂ ਦੇ ਵਾਸਤੇ ਜਿਹੜੇ ਟੀਕੇ ਦੀ ਲੋੜ ਹੈ ਉਹ ਪ੍ਰਾਈਵੇਟ ਹੋਸਪੀਟਲ ਵੀ ਹੈਗੇ ਆ ਸਰਕਾਰੀ ਦੇ ਵਿੱਚ ਮੈਂ ਇੰਨਾ ਕਦੇ ਮਤਲਬ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਮੈਨੂੰ ਪਤਾ ਕਿ ਉੱਥੇ ਹੈ ਜਾਂ ਨਹੀਂ ਤਾਂ ਇਸ ਚੀਜ਼ 'ਤੇ ਮੈਂ ਆਪਣੀ ਟਿੱਪਣੀ ਨਹੀਂ ਕਰਨਾ ਚਾਹਾਂਗੀ ਧੰਨਵਾਦ